ਪੰਜਾਬ ਵਿੱਚ ਸੱਭਿਆਚਾਰਕ ਅਤੇ ਸਮਾਜਿਕ ਪਰੰਪਰਾਵਾਂ ਹਨ ਜੋ ਪੀੜੀਆਂ ਤੋਂ ਚੱਲੀਆਂ ਆ ਰਹੀਆਂ ਹਨ ਅਤੇ ਅਜੇ ਵੀ ਬਹੁਤ ਮਸ਼ਹੂਰ ਹਨ ਜਿਵੇਂ ਕੋਈ ਸਮਾਗਮ ਹੁੰਦਾ ਘਰਾਂ ਵਿੱਚ ਵਿਆਹ ਸਮਾਗਮ ਸਭ ਤੋਂ ਮੇਨ ਜਾਂ ਸਭ ਤੋਂ ਮੁੱਖ ਸੱਭਿਆਚਾਰਕ ਪੱਖ ਹੈ ਇਹ ਸੱਤ ਤੋਂ ਦਸ ਦਿਨਾਂ ਤੱਕ ਦੇ ਸਮਾਗਮ ਹੁੰਦੇ ਹਨ ਘਰਾਂ ਵਿੱਚ ਵੱਖ ਵੱਖ ਟਾਈਪ ਦੀਆਂ ਰੀਤੀ ਰਿਵਾਜ ਜਿਹੜੇ ਨੇ ਉਹ ਮ ਮਨਾਏ ਜਾਂਦੇ ਹਨ ਜਿਵੇਂ ਲੜਕੇ ਦਾ ਵਿਆਹ ਹੋਵੇ ਤਾਂ ਘਰ ਦੇ ਵਿੱਚ ਵਟਣਾ ਮਲਣਾ ਲੜਕੀ ਦਾ ਮਹਿੰਦੀ ਦਾ ਰਸਮ ਹੋ ਗਈ ਇਹਦੀ ਵ ਇਨ੍ਹਾਂ ਵਿਆਹਾਂ ਦੇ ਵਿੱਚ ਵੱਖ ਵੱਖ ਕਿਸਮਾਂ ਦੀਆਂ ਪਰੰਪਰਾਵਾਂ ਚੱਲਦੀਆਂ ਹਨ ਜੋ ਅਜੇ ਵੀ ਚੱਲ ਰਹੀਆਂ ਹਨ ਇਹਨਾਂ ਨੂੰ ਪੁਰਾਤਨ ਨਹੀਂ ਮੰਨਿਆ ਜਾਂਦਾ ਹੋਰ ਟਾਈਪ ਦੇ ਲੋਕ ਮੇਲੇ ਪੰਜਾਬ ਦੇ ਵਿੱਚ ਬਹੁਤ ਮਸ਼ਹੂਰ ਨੇ ਜਦੋਂ ਗੁਰਪੁਰਬ ਸਾਹਿਬ ਹੁੰਦਾ ਹੈ ਉਦੋਂ ਸਵਾਰੀ ਸਾਹਿਬ ਨਿਕਲਦੀ ਹੈ ਨਗਰ ਕੀਰਤਨ ਵਿੱਚ ਸਭ ਲੋਕ ਸ਼ਰਧਾ ਨਾਲ ਸ਼ਾਮਿਲ ਹੁੰਦੇ ਹਨ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਹਨ ਪੰਜਾਬ ਦੇ ਵਿੱਚ ਲੋਕ ਮੇਲਿਆਂ ਦਾ ਬਹੁਤ ਹੀ ਮਹੱਤਵ ਹੈ ਵਿਸਾਖੀ ਦਾ ਮੇਲਾ ਲੋਹੜੀ ਦਾ ਤਿਉਹਾਰ ਬਸੰਤ ਦਾ ਮੇਲਾ ਇਹ ਜਗ੍ਹਾ ਜਗ੍ਹਾ 'ਤੇ ਲੱਗਦੇ ਹਨ ਸਾਰੇ ਲੋਕ ਨਵੇਂ ਕੱਪੜੇ ਪਾ ਕੇ ਨਵੇਂ ਕੱਪੜੇ ਪਾ ਕੇ ਇੱਕ ਦੂਜੇ ਦੇ ਨਾਲ ਖੁਸ਼ੀ ਦੇ ਨਾਲ ਮਿਲਦੇ ਹਨ ਦੂਜਿਆਂ ਨੂੰ ਮੁਬਾਰਕਬਾਦ ਦਿੰਦੇ ਹਨ ਅਤੇ ਆਪਣੇ ਬੱਚਿਆਂ ਨੂੰ ਸਾਰਾ ਰੋਣਕ ਮੇਲਾ ਵਿਖਾਉਣ ਦੇ ਲਈ ਲੈ ਕੇ ਜਾਂਦੇ ਹਨ ਉਹ ਆਪਣੇ ਬੱਚਿਆਂ ਨੂੰ ਆਪਣੇ ਪੁਰਾਤਨ ਪਰੰਪਰਾਵਾਂ ਦੇ ਨਾਲ ਜੋੜ ਕੇ ਰੱਖਦੇ ਹਨ